ਜੀ ਹਾਂ ਅਸੀਂ ਆਪਣੇ ਘਰ ਦੀਆਂ ਲਾਈਟਾਂ ਅਤੇ ਪੱਖੇ ਰਿਮੋਟਲੀ ਕੰਟ੍ਰੋਲ ਕਰਵਾਏ ਹੋਏ ਹਨ ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਵਰਤੋਂ ਨਾਲ ਜਦੋਂ ਅਸੀਂ ਰਿਮੋਟ ਨਾਲ ਇਹਨਾਂ ਨੂੰ ਵਰਤਦੇ ਹਾਂ ਤਾਂ ਠੀਕ ਹੈ ਕੁਝ ਆਸਾਨ ਹੋ ਗਿਆ ਹੈ ਜੀਵਨ ਸਾਡਾ ਅਸੀਂ ਆਪਣੇ ਬੈਡ 'ਤੇ ਬੈਠੇ ਬੈਠੇ ਅਗਰ ਪੱਖਾ ਤੇਜ਼ ਜਾਂ ਘੱਟ ਕਰਨਾ ਚਾਹੁੰਦੇ ਹਾਂ ਲਾਈਟ ਨੂੰ ਥੋੜ੍ਹਾ ਤੇਜ਼ ਜਾਂ ਡਿਮ ਕਰਨਾ ਚਾਹੁੰਦੇ ਹਾਂ ਤਾਂ ਉਹ ਬੈਠੇ ਬੈਠੇ ਕਰ ਸਕਦੇ ਹਾਂ ਸਾਨੂੰ ਉੱਠ ਕੇ ਅ ਜੋ ਹੈ ਕਰਨ ਦੀ ਜ਼ਰੂਰਤ ਨਹੀਂ ਹੈ ਖ਼ਾਸ ਕਰਕੇ ਰਾਤ ਦੇ ਸਮੇਂ ਇਹ ਚੀਜ਼ ਸਾਡੇ ਬਹੁਤ ਕੰਮ ਆਉਂਦੀ ਹੈ ਅੱਛਾ ਵੀ ਲੱਗਦਾ ਹੈ ਔਰ ਸੌਖਾ ਵੀ ਲੱਗਦਾ ਹੈ ਅਤੇ ਖੁਸ਼ੀ ਵੀ ਹੁੰਦੀ ਹੈ ਕਿ ਅਸੀਂ ਇੱਕ ਨਵੀਂ ਟੈਕਨੋਲੋਜੀ ਜਿਹੜੀ ਹੈ ਉਸਨੂੰ ਵਰਤ ਰਹੇ ਹਾਂ ਪਰ ਅਗਰ ਸੋਚਿਆ ਜਾਵੇ ਤਾਂ ਕੀ ਅਸਲ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈ ਜਾਂ ਨਹੀਂ ਇਹ ਪ੍ਰਸ਼ਨ ਜੋ ਹੈ ਸਾਨੂੰ ਸ਼ਸ਼ੋਪੰਜ ਵਿੱਚ ਪਾ ਦਿੰਦਾ ਹੈ ਕਿਉਂਕਿ ਉੱਠ ਕੇ ਲਾਈਟ ਬੰਦ ਕਰਨਾ ਜਾਂ ਪੱਖਾ ਬੰਦ ਕਰਨਾ ਜਾਂ ਪੱਖੇ ਨੂੰ ਉਹਦੀ ਹਵਾ ਨੂੰ ਘੱਟ ਜਾਂ ਵੱਧ ਕਰਨਾ ਉੱਠ ਕੇ ਕੋਈ ਇੰਨਾ ਮੁਸ਼ਕਿਲ ਕੰਮ ਨਹੀਂ ਹੈ ਸਾਡੇ ਜੀਵਨ ਵਿੱਚ ਤਾਂ ਪਹਿਲਾਂ ਹੀ ਸ਼ਰੀਰਕ ਜੋ ਕਸਰਤ ਹੈ ਸਰੀਰ ਦਾ ਜੋ ਤੁਰਨਾ ਫਿਰਨਾ ਹੈ ਉਹ ਪਹਿਲਾਂ ਹੀ ਘਟਿਆ ਹੋਇਆ ਹੈ ਅਤੇ ਅਸੀਂ ਜੋ ਇਹ ਸਿਸਟਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਉਸ ਨਾਲ ਤਾਂ ਸਾਡਾ ਸਰੀਰ ਹੋਰ ਵੀ ਜੋ ਹੈ ਉਹ ਬੈਠਦਾ ਜਾ ਰਿਹਾ ਹੈ ਇਸ ਨੂੰ ਉੱਠ ਕੇ ਕੰਮ ਕਰਨ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੋ ਰਹੀ